ਟੈਕਨੋਲੋਜੀ ਅੱਜ ਕੱਲ੍ਹ ਇੱਕ ਬਹੁਤ ਹੀ ਵਿਸ਼ਾਲ ਰੂਪ ਵਿੱਚ ਵੱਧ ਚੁੱਕੀ ਹੈ ਟੈਕਨੋਲੋਜੀ ਦੇ ਦੁਆਰਾ ਯਾਤਰਾ ਕਰਨ ਅਤੇ ਸੰਸਾਰ ਪੜਚੋਲ ਵਿੱਚ ਬਹੁਤ ਜ਼ਿਆਦਾ ਬਦਲਾਵ ਆ ਗਿਆ ਹੈ ਅਤੇ ਇਹ ਇੱਕ ਬਹੁਤ ਹੀ ਚੰਗਾ ਬਦਲਾਵ ਹੈ ਜਿੱਦਾਂ ਅੱਜ ਕੱਲ੍ਹ ਅਸੀਂ ਘਰ ਬੈਠਿਆਂ ਹੀ ਕੋਈ ਵੀ ਟਿਕਟਾਂ ਬੁੱਕ ਕਰ ਸਕਦੇ ਹਾਂ ਕੋਈ ਵੀ ਪਰੇਸ਼ਾਨੀ ਤੋਂ ਬਿਨਾਂ ਕਿਤੇ ਵੀ ਜਾਣ ਜਾਣ ਬਾਰੇ ਪਤਾ ਕਰ ਸਕਦੇ ਹਾਂ ਉੱਥੋਂ ਦੇ ਹੋਟਲ ਜਾਂ ਫਿਰ ਰਹਿਣ ਸਹਿਣ ਦਾ ਤਰੀਕਾ ਪਹਿਲੇ ਹੀ ਦੇਖ ਕੇ ਔਨਲਾਈਨ ਬੁਕਿੰਗ ਵੀ ਕਰ ਸਕਦੇ ਹਾਂ ਅੱਜ ਕੱਲ੍ਹ ਸਾਡੀ ਛੋਟੀ ਤੋਂ ਛੋਟੀ ਪਰੇਸ਼ਾਨੀਆਂ ਕੋਈ ਵੀ ਸਵਾਲ ਪੁੱਛਣ ਲਈ ਅਸੀਂ ਏ ਆਈ ਚੈਟ ਬੋਰਟਸ ਦਾ ਇਸਤੇਮਾਲ ਕਰ ਸਕਦੇ ਹਾਂ ਅੱਜ ਕੱਲ੍ਹ ਜਗ੍ਹਾ ਜਗ੍ਹਾ 'ਤੇ ਕਿਊ ਆਰ ਕੋਡ ਲੱਗੇ ਹੁੰਦੇ ਹਨ ਜਿਸ ਰਾਹੀਂ ਅਸੀਂ ਡਾਇਰੈਕਟ ਬੈਂਕ ਟਰਾਂਸਫਰ ਕਰ ਕੇ ਕਿਸੇ ਦੇ ਅਕਾਊਂਟ ਵਿੱਚ ਵੀ ਪੈਸੇ ਪਾ ਸਕਦੇ ਹਾਂ ਜਾਂ ਇੱਕ ਦੂਜੇ ਨੂੰ ਪੈਸੇ ਭੇਜ ਸਕਦੇ ਹਾਂ ਜਾਂ ਫਿਰ ਕਿਸੇ ਵੀ ਵੈੱਬਸਾਈਟ ਨੂੰ ਸਰਚ ਕਰਨ ਲਈ ਅਸੀਂ ਕਿਊ ਆਰ ਕੋਡ ਨੂੰ ਇਸਤੇਮਾਲ ਕਰ ਸਕਦੇ ਹਾਂ ਇੱਦਾਂ ਹੀ ਕਿਊ ਆਰ ਕੋਡ ਜਨਰੇਟ ਕਰਕੇ ਅਸੀਂ ਕਿਸੇ ਹੋਟਲ ਦੇ ਮੈਨਊਜ ਨੂੰ ਵੀ ਵੇਖ ਸਕਦੇ ਹਾਂ ਇਸ ਲਈ ਸਾਡਾ ਅੱਜ ਕੱਲ੍ਹ ਪੇਪਰ ਵਰਕ ਵੀ ਬਹੁਤ ਘੱਟ ਹੋ ਗਿਆ ਹੈ ਅਤੇ ਕੋਈ ਵੀ ਨੋਟ ਵਗੈਰਾ ਦੀ ਵੀ ਇੰਨੀ ਟੈਨਸ਼ਨ ਨਹੀਂ ਰਹੀ ਇਸ ਕਰਕੇ ਸਾਡਾ ਕੰਮ ਬਹੁਤ ਜ਼ਿਆਦਾ ਆਸਾਨ ਹੋ ਗਿਆ ਹੈ ਜੋ ਕੰਮ ਕਰਨ ਲਈ ਸਾਨੂੰ ਕਦੀ ਬਾਹਰ ਜਾਣਾ ਪੈਂਦਾ ਸੀ ਜਾਂ ਬਹੁਤ ਜ਼ਿਆਦਾ ਸਮਾਂ ਲੱਗ ਸਕਦਾ ਸੀ ਅੱਜ ਕੱਲ੍ਹ ਉਹ ਸਾਰੇ ਕੰਮ ਔਨਲਾਈਨ ਤੋਂ ਬਹੁਤ ਜਲਦੀ ਹੋ ਗਏ ਹਨ ਇਹੀ ਹੈ ਟੈਕਨੋਲਜੀ ਜੋ ਕਿ ਸਾਡੇ ਕੰਪਿਊਟਰ ਸਾਇੰਸ ਦੇ ਸੋਫਟਵੇਅਰ ਇੰਜੀਨੀਅਰਿੰਗ ਦੀ ਦੇਣ ਹੈ ਜਿਸ ਦੀ ਵਜ੍ਹਾ ਨਾਲ ਇਹ ਅੱਜ ਕੱਲ੍ਹ ਬਹੁਤ ਜ਼ਿਆਦਾ ਐਡਵਾਂਸ ਹੋ ਚੁੱਕੀ ਹੈ ਅਤੇ ਇਸ 'ਤੇ ਆਇਆ ਆਏ ਹੋਏ ਬਦਲਾਵ ਬਹੁਤ ਚੰਗੇ ਹਨ